ਵਿਗਿਆਪਨ ਦੇ ਥਰੂ ਵਧੇਰੇ ਜਾਣਕਾਰੀ ਦਿੱਤੀ ਜਾਂਦੀ ਹੈ ਜਾਗਰੂਕ ਕੀਤਾ ਜਾਂਦਾ ਹੈ ਅਤੇ ਵਧੇਰੇ ਲੋਕਾਂ ਤੱਕ ਪਹੁੰਚਿਆ ਜਾ ਸਕਦਾ ਹੈ ਜਿਵੇਂ ਕਿ ਅਸੀਂ ਕੋਈ ਵੀ ਵਿਗਿਆਪਨ ਕਰਦੇ ਹਾਂ ਉਸ ਚੀਜ਼ ਬਾਰੇ ਬਾਕੀ ਲੋਕਾਂ ਨੂੰ ਪਤਾ ਲੱਗਦਾ ਹੈ ਕੋਈ ਵੀ ਅਗਰ ਇੰਨਫੋਰਮੇਸ਼ਨ ਅਸੀਂ ਸਾਰਿਆਂ ਤੱਕ ਪਹੁੰਚਾਉਣੀ ਹੋਵੇ ਤਾਂ ਅਸੀਂ ਇਸ ਦੀ ਮਦਦ ਲੈਂਦੇ ਹਾਂ ਜਿਵੇਂ ਕਿ ਕੋਹੇ ਵੀ ਚੀਜ਼ ਬਾਰੇ ਪਤਾ ਕਰਨਾ ਹੋਵੇ ਕੋਈ ਵੀ ਨਵੀਂ ਨਿਊਜ਼ ਆਈ ਹੋਵੇ ਤਾਂ ਇਸ਼ਤਿਹਾਰ ਵਿੱਚ ਦੇ ਦਿੱਤਾ ਜਾਂਦਾ ਹੈ ਜਿਸ ਨਾਲ ਬਾਕੀ ਲੋਕ ਵੀ ਜਾਗਰੂਕ ਹੋ ਜਾਂਦੇ ਹਨ ਜਿਵੇਂ ਕਿ ਪਿਛਲੇ ਕੁਛ ਟਾਈਮ ਪਹਿਲਾਂ ਇੱਕ ਹਾਦਸਾ ਹੋਇਆ ਸੀ ਜੋ ਕਿ ਪੰਜਾਬ ਗਾਇਕ ਸਿੱਧੂ ਮੂਸੇ ਵਾਲੇ ਨਾਲ ਵਾਪਰਿਆ ਸੀ ਉਹਨਾਂ ਨੂੰ ਦਿਨ ਦਿਹਾੜੇ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਸੜਕ 'ਤੇ ਜੋ ਕਿ ਬਹੁਤ ਹੀ ਪ੍ਰਸਿੱਧ ਗਾਇਕ ਸਨ ਉਹਨਾਂ ਦੇ ਇਸ ਹਾਦਸੇ ਦੀ ਦੁੱਖ ਭਰੀ ਘਟਨਾ ਨਾਲ ਬਹੁਤ ਲੋਕ ਪ੍ਰਭਾਵਿਤ ਹੋਏ ਸਨ ਕਿਉਂਕਿ ਉਹ ਬਹੁਤ ਹੀ ਚੰਗੇ ਇਨਸਾਨ ਸਨ ਜੋ ਕਿ ਸਭ ਦਾ ਭਲਾ ਕਰਦੇ ਸਨ ਅਤੇ ਸੱਚੀਆਂ ਗੱਲਾਂ ਦੱਸਦੇ ਸਨ ਇਸ ਕਰਕੇ ਅਸੀਂ ਸਾਰੇ ਜਨਤਾ ਨੂੰ ਇਹ ਪਤਾ ਲੱਗਾ ਸੀ ਕਿ ਉਹਨਾਂ ਨਾਲ ਬਹੁਤ ਦੁੱਖ ਭਰੀ ਘਟਨਾ ਹੋਈ ਹੈ ਇਸ ਨਾਲ ਅਸੀਂ ਜਾਣ ਸਕਦੇ ਹਾਂ ਕਿ ਕਿੱਥੇ ਕਿਹੜੀ ਚੀਜ਼ ਘਟੀ ਹੈ ਸਾਨੂੰ ਬਹੁਤ ਜ਼ਿਆਦਾ ਜਾਣਕਾਰੀ ਮਿਲਦੀ ਹੈ ਧੰਨਵਾਦ